ਸਾਡੇ ਜਿਲ੍ਹੇ ਅੰਮ੍ਰਿਤਸਰ ਵਿੱਚ ਰਾਮ ਤੀਰਥ ਦੁਰਗਿਆਣਾ ਮੰਦਰ ਦਰਬਾਰ ਸਾਹਿਬ ਨੇ ਇਹ ਪ੍ਰੰਪਰਾਗਤ ਜ਼ਿਲ੍ਹੇ ਦੇ ਭਾਈਚਾਰੇ ਨੂੰ ਇੰਝ ਦਰਸਾਉਂਦੇ ਨੇ ਕਿ ਚਾਹੇ ਕੋਈ ਹਿੰਦੂ ਹੈ ਸਿੱਖ ਹੈ ਚਾਹੇ ਕੋਈ ਦਰਬਾਰ ਸਾਹਿਬ ਜਾਵੇ ਅਤੇ ਚਾਹੇ ਕੋਈ ਰਾਮ ਤੀਰਥ ਜਾਵੇ ਇਹਦੇ ਵਿੱਚ ਕੋਈ ਪਰਹੇਜ ਨਹੀਂ ਹੈਗਾ ਕੋਈ ਕਿਸੇ ਦੀ ਮਨਾਹੀ ਨਹੀਂ ਗੀ ਕਿਸੇ ਵੀ ਤਰ੍ਹਾਂ ਦੀ ਹਰ ਕੋਈ ਮਿਲ ਜੁਲ ਕੇ ਰਹਿੰਦਾ ਹੈ ਚਾਹੇ ਅਸੀਂ ਲੋਕ ਜਿਵੇਂ ਮਰਜ਼ੀ ਹੈਗੇ ਹਾਂ ਆਪਸ ਵਿੱਚ ਬੜੇ ਪ੍ਰੇਮ ਨਾਲ ਰਹਿੰਦੇ ਹਾਂ ਕਿਸੇ ਨੂੰ ਨਹੀਂ ਲੱਗਦਾ ਕਿ ਉਹ ਹਿੰਦੂ ਹੈ ਸਿੱਖ ਹੈ ਸਿਰਫ ਇਹ ਹੈ ਕਿ ਜਿਹੜੇ ਆਮ ਲੋਕ ਨੇ ਸੋਸ਼ਲ ਮੀਡੀਆ ਉਹ ਹੀ ਅਫਵਾਹਾਂ ਫੈਲਾਉਂਦਾ ਸਾਡੇ ਜਿਲ੍ਹੇ ਦੇ ਵਿੱਚ ਸਭ ਮਿਲ ਜੁਲ ਕੇ ਰਹਿੰਦੇ ਨੇ ਅਤੇ ਇੱਕ ਦੂਜੇ ਦੇ ਧਰਮ ਦੀ ਇੱਜ਼ਤ ਵੀ ਕਰਦੇ ਨੇ ਹਰ ਕੋਈ ਆਪਣੀ ਕਹਿ ਲਓ ਕਿ ਜਿਸ ਤਰ੍ਹਾਂ ਹੁਣ ਰਾਮ ਤੀਰਥ ਹੈ ਉੱਥੇ ਕਈ ਤਰ੍ਹਾਂ ਦੇ ਹਿੰਦੂ ਵੀ ਜਾਂਦੇ ਨੇ ਅਤੇ ਸਿੱਖ ਵੀ ਜਾਂਦੇ ਨੇ ਦਰਬਾਰ ਸਾਹਿਬ ਹੈ ਅਤੇ ਉੱਥੇ ਕਹਿ ਲਓ ਕਿ ਅਗਰ ਸਿੱਖ ਜਾਂਦੇ ਨੇ ਤਾਂ ਕਿੰਨੇ ਪਰਸੈਂਟ ਹਿੰਦੂ ਵੀ ਜਾਂਦੇ ਨੇ ਸ਼ਹੀਦਾਂ ਸਾਹਿਬ ਗੁਰਦੁਆਰਾ ਹੈ ਉੱਥੇ ਕਹਿ ਲਓ ਕਿ ਸਿੱਖਾਂ ਦੇ ਬਰਾਬਰ ਹੀ ਹਿੰਦੂ ਵੀ ਜਾਂਦੇ ਨੇ ਅਤੇ ਜ਼ਿਲ੍ਹੇ ਦੇ ਵਿੱਚ ਪੂਰਾ ਭਾਈਚਾਰਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ